ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਮੈਮ ਹਾਂਜੀ ਠੀਕ ਠਾਕ ਜੀ ਬਸ ਕੁਝ ਨਹੀਂ ਮੈਮ ਫਰੀ ਸੀ ਹਾਂਜੀ ਹਾਂਜੀ ਸ਼ੋਪਿੰਗ ਹਾਂਜੀ ਸ਼ੋਪਿੰਗ ਕਰਨ ਜਾਈਦੇ ਆ ਬਟ ਰਸਤੇ ਦੇ ਵਿੱਚ ਟਰੈਫਿਕ ਹੀ ਬੜਾ ਹੁੰਦਾ ਅੱਜ ਕੱਲ੍ਹ ਤੁਹਾਨੂੰ ਪਤਾ ਹੀ ਆ ਕਿ ਸੀਜ਼ਨ ਤਿਉਹਾਰਾਂ ਦਾ ਚੱਲ ਰਿਹਾ ਤਿਉਹਾਰਾਂ ਦਾ ਮੌਸਮ ਅਤੇ ਬਹੁਤ ਜ਼ਿਆਦਾ ਰਸ਼ ਹੁੰਦਾ ਆ ਹਾਂਜੀ ਕੱਲ੍ਹ ਵੀ ਅਸੀਂ ਕੱਲ੍ਹ ਵੀ ਅਸੀਂ ਜਿਵੇਂ ਆ ਰਹੇ ਸੀਗੇ ਜਲੰਧਰ ਤੋਂ ਕਪੂਰਥਲਾ ਆਉਂਦੇ ਟਾਈਮ ਤਾਂ ਬਹੁਤ ਜ਼ਿਆਦਾ ਹੀ ਉੱਥੇ ਜਾਮ ਲੱਗਾ ਹੋਇਆ ਸੀਗਾ ਕਪੂਰਥਲਾ ਚੌਂਕ ਤੋਂ ਲੈ ਕੇ ਬਸਤੀ ਤੱਕ ਹਾਂਜੀ ਹਾਂਜੀ ਬੜੀ ਮੁਸ਼ਕਿਲ ਦੇ ਨਾਲ ਉਥੋਂ ਅਸੀਂ ਨਿਕਲ ਕੇ ਆਏ ਹਾਂ ਹਾਂਜੀ ਹਾਂਜੀ ਹਾਂਜੀ ਹੋਰ ਤੁਸੀਂ ਸੁਣਾਓ ਅੱਛਾ ਹਾਂਜੀ ਹਾਂਜੀ ਹਾਂਜੀ ਹਾਂਜੀ ਉਹਦਾ ਅਸਰ ਪਰ ਹੁੰਦਾ ਜਿੱਦਾਂ ਉਹ ਜਿਹੜਾ ਮੇਨ ਰੋਡ ਆ ਉੱਥੇ ਉਹਦੇ ਉੱਪਰ ਹੀ ਹੁੰਦਾ ਜ਼ਿਆਦਾ ਅਤੇ ਇਹ ਤਾਂ ਚਲੋ ਜਲੰਧਰ ਤੋਂ ਕਪੂਰਥਲਾ ਇੱਥੇ ਫਿਰ ਬਸਤੀ ਬਾਵਾ ਖੇਲ 'ਚ ਬਹੁਤ ਰਸ਼ ਹੁੰਦਾ ਜਦੋਂ ਸੇਲ ਵਗੈਰਾ ਲੱਗੀ ਹੁੰਦੀ ਆ ਫਿਰ ਬਹੁਤ ਰਸ਼ ਹੁੰਦਾ ਉੱਥੇ

ਹਾਂਜੀ ਹਾਂਜੀ ਚਲੋ ਆਪਾਂ ਕਦੋਂ ਮਿਲਦੇ ਆ ਹੁਣ ਫਿਰ ਇਸ ਐਤਵਾਰ ਨੂੰ ਮਿਲਦੇ ਆ ਆਪਾਂ ਠੀਕ ਹੈ ਜੀ ਓਕੇ ਜੀ ਓਕੇ ਬਾਏ